ਜਦੋਂ ਮੈਨੂੰ ਥੋੜ੍ਹੇ ਦਿਨਾਂ ਲਈ ਕਿਤੇ ਬਾਹਰ ਜਾਣਾ ਪਵੇ ਤਾਂ ਮੈਂ ਜੋ ਗਮਲਿਆਂ ਵਿੱਚ ਪੌਦੇ ਹਨ ਉਹਨਾਂ ਵਿੱਚ ਰੱਸੀਆਂ ਗਿੱਲੀਆਂ ਕਰ ਕੇ ਰੱਖ ਦਿੰਦੀ ਹਾਂ ਤਾਂ ਜੋ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਪਾਣੀ ਗਮਲਿਆਂ ਨੂੰ ਮਿਲਦਾ ਰਹੇ ਮੇਰੇ ਪੌਦੇ ਸੁੱਕਣ ਸੜਨ ਨਾ ਅਤੇ ਜੋ ਵੱਡੇ ਪੌਦੇ ਹਨ ਉਹਨਾਂ ਨੂੰ ਪਾਣੀ ਦੇ ਕੇ ਚਲੀ ਜਾਂਦੀ ਹਾਂ ਅਤੇ ਮੇਰੇ ਪਰਿਵਾਰਿਕ ਮੈਂਬਰ ਵੀ ਮੇਰਾ ਸਹਿਯੋਗ ਦਿੰਦੇ ਹਨ ਮੇਰੇ ਜਾਣ ਮਗਰੋਂ ਮੇਰੇ ਪਰਿਵਾਰ ਵਾਲੇ ਉਹਨਾਂ ਪੌਦਿਆਂ ਦਾ ਧਿਆਨ ਪੂਰੀ ਤਰ੍ਹਾਂ ਰੱਖਦੇ ਹਨ ਉਹਨਾਂ ਨੂੰ ਸਮੇਂ ਸਿਰ ਪਾਣੀ ਦਿੰਦੇ ਹਨ ਖਾਦਾਂ ਦਵਾਈਆਂ ਦਿੰਦੇ ਹਨ ਉਹਨਾਂ ਦੀ ਗੁਡਾਈ ਅਤੇ ਸਫਾਈ ਕਰਦੇ ਰਹਿੰਦੇ ਹਨ ਮੇਰੇ ਪੌਦੇ ਬਹੁਤ ਹਰੇ ਭਰੇ ਅਤੇ ਸੋਹਣੇ ਸਜਾਵਟੀ ਹਨ